ਸਤਿ ਸ਼੍ਰੀ ਅਕਾਲ ਜੀ ਮੈਂ ਕੁਝ ਦਿਨਾਂ ਪਹਿਲਾਂ ਤੁਹਾਡੇ ਤੋਂ ਇੱਕ ਹੈਡਬੈਗ ਦੀ ਔਡਰ ਕੀਤਾ ਸੀਗਾ ਜਦੋਂ ਉਹ ਮੈਨੂੰ ਇਹ ਹੈਡਬੈਗ ਮਿਲਿਆ ਤਾਂ ਇਸ ਨੂੰ ਬਹੁਤ ਜ਼ਿਆਦਾ ਸਮੇਂ ਲੱਗ ਗਿਆ ਸੀਗਾ ਅਤੇ ਇਸ ਦੀ ਪੈਕਿੰਗ ਵੀ ਕੁਝ ਖਾਸ ਵਧੀਆ ਨਹੀਂ ਸੀ ਜਦੋਂ ਮੈਂ ਇਹ ਹੈਡ ਪੈਕਿੰਗ ਖੋਲ਼੍ਹੀ ਤਾਂ ਹੈਡਬੈਗ ਆਪਣੀ ਸਹੀ ਕੰਡੀਸ਼ਨ ਵਿੱਚ ਨਹੀਂ ਸੀਗਾ ਜਿਹੜਾ ਕਲਰ ਮੈਂ ਮੰਗਾਇਆ ਸੀਗਾ ਉਸਤੋਂ ਬਿਲਕੁੱਲ ਡਿੰਫਰੈਂਟ ਕਲਰ ਮੈਨੂੰ ਮਿਲਿਆ ਅਤੇ ਜਦੋਂ ਮੈਂ ਇਹ ਖੋਲ ਕੇ ਦੇਖਿਆ ਤਾਂ ਇਸ ਵਿੱਚ ਨਾ ਤਾਂ ਐਨੀਆਂ ਜੇਬਾਂ ਸੀਗੀਆਂ ਜਿਹਦੇ ਵਿੱਚ ਮੈਂ ਆਪਣਾ ਸਮਾਨ ਬਹੁਤ ਚੰਗੀ ਤਰ੍ਹਾਂ ਰੱਖ ਸਕਾ ਅਤੇ ਇਹਦੀਆਂ ਚੇਨਸ ਤੀਆ ਜੋ ਉਹ ਬਿਲਕੁੱਲ ਵੀ ਮਜ਼ਬੂਤ ਨਹੀਂ ਸੀਗੀਆਂ ਅਤੇ ਹੱਥ ਲਗਾਏ ਤੋਂ ਐਂਵੇ ਲੱਗਦਾ ਸੀ ਕਿ ਇਹ ਚੇਨ ਹੁਣੇ ਟੁੱਟ ਜਾਊਗੀ ਅਤੇ ਇਹ ਮੈਨੂੰ ਮਾਰਕਿਟ ਨਾਲੋਂ ਵੀ ਬਹੁਤ ਜ਼ਿਆਦਾ ਮਹਿੰਗਾ ਮਿਲਿਆ ਅਤੇ ਮੈਂ ਕਿਸੀ ਨੂੰ ਪ੍ਰੈਫ਼ਰ ਨਹੀਂ ਕਰਾਂਗੀ ਕਿ ਇਹ ਬੈਗ ਲਿਆ ਜਾਵੇ

ਨਹੀਂ ਤਾਂ ਮੈ ਇਹਨੂੰ ਅਸਾਨੀ ਨਾਲ਼ ਆਪਣੇ ਹੱਥ ਫੜ ਸਕਦੀ ਕਿਉਂਕਿ ਇਹ ਚੱਕਣ ਵਿੱਚ ਵੀ ਇੰਨਾਂ ਅਜੀਬ ਲੱਗਦਾ ਸੀ ਕਿ ਕੋਈ ਦੇਖ ਕੇ ਕੀ ਕਹੂਗਾ ਅਤੇ ਅਸੀਂ ਨਾ ਤਾਂ ਇਹ ਨੂੰ ਇੱਕ ਸਾਈਡ ਬੈਗ ਸਾਈਡ ਬੈਗ ਦੀ ਤਰ੍ਹਾਂ ਯੂਜ਼ ਕਰ ਸਕਦੇ ਸੀ ਨਾ ਤਾਂ ਇਹਦੇ ਨਾਲ਼ ਕੋਈ ਚੇਨ ਸੀ ਤਾਂ ਮੈਂ ਆਹੀ ਬੇਨਤੀ ਕਰਦੀ ਹਾਂ ਕਿ ਇਹ ਜਿਹੜਾ ਮੇਰਾ ਪ੍ਰੋਡਕਟ ਮੈਂ ਮੰਗਵਾਇਆ ਇਹ ਜਾਂ ਤਾਂ ਤੁਸੀਂ ਰੀਫੰਡ ਕਰਲੋ ਜਾਂ ਤਾਂ ਮੈਨੂੰ ਇਸ ਨਾਲੋਂ ਜੋ ਓਰੀਜਨਲ ਬੈਗ ਹੈ ਉਹ ਮੈਨੂੰ ਦਿੱਤਾ ਜਾਵੇ ਧੰਨਵਾਦ